ਭਾਜੀ ਸੱਸਰੀਕਾਲ ਜੀ ਭਾਜੀ ਸ਼ਗਨ ਢਾਬੇ ਤੋਂ ਬੋਲਦੇ ਆ ਜੀ ਭਾਜੀ ਆਪਾਂ ਨੇ ਔਡਰ ਕਰਿਆ ਤਾ ਜੀ ਖਾਣ ਪੀਣ ਦਾ ਰੋਟੀ ਅਰ ਸਰ੍ਹੋਂ ਦਾ ਸਾਗ ਔਡਰ ਕਰਿਆ ਤਾ ਜੀ ਭਾਜੀ ਹਲੇ ਤੱਕ ਨਹੀਂ ਪਹੁੰਚਿਆ ਜੀ ਡਿਲਵਰੀ ਨਾ ਤੁਹਾਡੀ ਡਿਲਵਰੀ ਵਾਲਾ ਆਇਆ ਏ ਜੀ ਨਾ ਟਾਇਮ ਲੱਗ ਗਿਆ ਮਤਲਬ ਘੰਟਾ ਕੁ ਹੋ ਗਿਆ ਜੀ ਡੇਢ ਦੋ ਘੰਟੇ ਕਦ ਤੱਕ ਔਡਰ ਪੁੱਜ ਜੂਗਾ ਭਾਜੀ ਤਾਂ ਕਰਕੇ ਫੋਨ ਕਰਿਆ ਤਾ ਜੀ ਤੁਹਾਨੂੰ ਆਪਾਂ ਨੇ ਹਾਂਜੀ ਮਾੜਾ ਜਿਹਾ ਦੱਸ ਦਿੰਦੇ ਜੀ ਚਲੋ ਠੀਕ ਆ ਭਾਜੀ ਚੰਗਾ ਜੀ